ਨਹੀਂ ਬਿਲਕੁਲ ਵੀ ਨਹੀਂ ਕੋਈ ਜ਼ਰੂਰੀ ਨਹੀਂ ਹੈ ਕਿ ਕੋਈ ਜਿਹੜਾ ਸਿੱਖਿਅਤ ਬੰਦਾ ਏ ਉਹ ਹਰ ਜਿਹੜੇ ਉਹਦੇ ਵਿਵਹਾਰ ਔਰ ਸਿਧਾਂਤ ਜਿਹੜੇ ਉਹਦੇ ਸਹੀ ਹੋਣ ਔਰ ਜਾਂ ਉਹਨਾਂ ਦੀ ਉਹ ਅੱਛੀ ਤਰ੍ਹਾਂ ਪਾਲਣਾ ਕਰਦਾ ਹੋਵੇ ਇੱਕ ਜਿਹੜਾ ਅਨਸਿੱਖਿਅਤ ਵਿਅਕਤੀ ਵੀ ਉਹਦੇ ਨਾਲੋਂ ਜ਼ਿਆਦਾ ਵਧੀਆ ਜਿਹੜਾ ਅੱਛਾ ਵਿਵਹਾਰ ਔਰ ਸਿਧਾਂਤਾਂ ਦਾ ਮਾਲਕ ਹੋ ਸਕਦਾ ਹੈ